ਵੈਸੇ ਤਾਂ ਸਾਡੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਟਰੈਵਲਿੰਗ ਕੰਪਨੀਆਂ ਹਨ ਅਤੇ ਇਨ੍ਹਾਂ ਟਰੈਵਲਿੰਗ ਕੰਪਨੀਆਂ ਨੇ ਅੱਗੇ ਏਜੰਟ ਰੱਖੇ ਹੁੰਦੇ ਹਨ ਜੋ ਕਿ ਇਨ੍ਹਾਂ ਨੂੰ ਅੱਗੇ ਕੰਮ ਪ੍ਰੋਵਾਈਡ ਕਰਦੇ ਨੇ ਅੱਗੇ ਕੰਮ ਦਿੰਦੇ ਨੇ ਅਤੇ ਇਵੇਂ ਹੀ ਆਈ ਆਈ ਟੀ ਦੇ ਵਿੱਚ ਵੀ ਅਰੁਣਜੀਤ ਟਰੈਵਲਿੰਗ ਦੀਆਂ ਬਹੁਤ ਬੱਸਾਂ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਅੰਬੂਜਾ ਫੈਕਟਰੀ ਦੇ ਵਿੱਚ ਵੀ ਬਹੁਤ ਨੇ ਬਹੁਤ ਬੱਸਾਂ ਚੱਲਦੀਆਂ ਨੇ ਇਵੇਂ ਕੰਪਨੀਆਂ ਦੀਆਂ ਅਤੇ ਉਸ ਤੋਂ ਬਾਅਦ ਜੋ ਕਿ ਸਵਰਾਜ ਫੈਕਟਰੀ ਖੁਦ ਬੱਸਾਂ ਤਿਆਰ ਕਰਦੀ ਹੈ ਤਾਂ ਉਹ ਵੀ ਬੱਸਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਅਤੇ ਇਵੇਂ ਹੀ ਜੇ ਅਗਰ ਕਿਤੇ ਸਾਨੂੰ ਕਿਤੇ ਦੂਰ ਨੇੜੇ ਜਾਣਾ ਹੋਵੇ ਤਾਂ ਬਹੁਤ ਹੀ ਜ਼ਿਆਦਾ ਆਪਾਂ ਇਨ੍ਹਾਂ ਏਜੰਟਾਂ ਥਰੂ ਹੀ ਟਰੈਵਲਿੰਗ ਨਾਲ ਗੱਲ ਕਰ ਸਕਦੇ ਹਾਂ ਅਤੇ ਇਵੇਂ ਹੀ ਜੋ ਕਿ ਇਨ੍ਹਾਂ ਦੇ ਡਰਾਈਵਰ ਹੁੰਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ ਹਰ ਇੱਕ ਗੱਲ ਨੂੰ ਸਮਝਦੇ ਨੇ ਬਹੁਤ ਤਰੀਕੇ ਨਾਲ ਗੱਲ ਕਰਦੇ ਨੇ ਇਵੇਂ ਹੀ ਲੌਂਗ ਕਿਤੇ ਜਾਣਾ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਸਰਵਿਸ ਨੇ ਇਨ੍ਹਾਂ ਦੀਆਂ ਤਾਂ ਬਹੁਤ ਜ਼ਿਆਦਾ ਵਧੀਆ ਕੰਫਰਟੇਬਲ ਬੱਸਾਂ ਨੇ ਏਸੀ ਲੱਗੇ ਹੁੰਦੇ ਨੇ ਸੀਟਾਂ ਵੀ ਕੰਫਰਟੇਬਲ ਨੇ ਜੋ ਕਿ ਇਨ੍ਹਾਂ ਦਾ ਸਟਾਫ ਹੈ ਉਹ ਵੀ ਵਧੀਆ ਸਰਵਿਸ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਨ੍ਹਾਂ ਦੀ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਹੀ ਜ਼ਿਆਦਾ ਏਜੰਟ ਨੇ ਟਰੈਵਲਿੰਗ ਕੰਪਨੀਆਂ ਨੇ ਜੋ ਇਵੇਂ ਕੰਮ ਕਰਦੀਆਂ ਨੇ